ਖੇਡਾਂ ਦਾ ਜੀਵਨ ਵਿੱਚ ਅਹਿਮ ਸਥਾਨ ਹੈ ਸਿੱਖਿਆ ਨਾਲ ਬੋਧਿਕ ਅਤੇ ਅਧਿਆਤਮਿਕ ਵਿਕਾਸ ਹੁੰਦਾ ਹੈ ਜਦੋਂ ਕਿ ਖੇਡਾਂ ਮਨੁੱਖ ਦਾ ਸਰੀਰਕ ਵਿਕਾਸ ਕਰਦੀਆਂ ਹਨ ਮਨੁੱਖ ਉਦੋਂ ਹੀ ਸੰਪੂਰਨ ਹੁੰਦਾ ਹੈ ਜਦੋਂ ਉਸਦਾ ਸਰਵਪੱਖੀ ਵਿਕਾਸ ਹੁੰਦਾ ਹੈ ਪੁਰਾਣਿਆਂ ਸਮਿਆਂ ਵਿੱਚ ਖੇਡਾਂ ਨੂੰ ਸਮੇਂ ਦੀ ਬਰਬਾਦੀ ਕਿਹਾ ਜਾਂਦਾ ਸੀ ਪਰ ਅੱਜ ਸਮਾਂ ਬਦਲ ਗਿਆ ਹੈ ਸਿਹਤਮੰਦ ਸਰੀਰ ਵਿੱਚ ਇੱਕ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਇਹ ਹਮੇਸ਼ਾਂ ਕਿਹਾ ਜਾਂਦਾ ਹੈ ਹਮੇਸ਼ਾਂ ਬਿਮਾਰ ਵਿਅਕਤੀ ਬੇਚੈਨ ਰਹਿੰਦਾ ਹੈ ਉਲਝਿਆ ਹੁੰਦਾ ਹੈ ਉਹ ਕੁਝ ਵੀ ਸੋਚ ਨਹੀਂ ਸਕਦਾ ਉਹ ਜੀਵਨ ਤੋਂ ਬੇਗੈਰ ਹੋ ਜਾਂਦਾ ਹੈ ਅਜਿਹੀ ਵਿਅਕਤੀ ਦੀ ਯਾਦਾਸ਼ਤ ਵੀ ਘੱਟ ਹੁੰਦੀ ਹੈ ਜਾਂਦੀ ਹੈ ਸਾਰੀ ਸ਼ਾਸਤਰਾਂ ਨੇ ਵੀ ਸਿਹਤ ਦੀ ਮਹੱਤਤਾ ਨੂੰ ਮੰਨਿਆ ਗਿਆ ਸਿਹਤ ਦੀ ਰੱਖਿਆ ਲਈ ਕਸਰਤਾਂ ਬਹੁਤ ਜ਼ਰੂਰੀ ਹਨ ਇਸ ਲਈ ਸਾਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਖੇਡਾਂ ਵਿੱਚ ਆਪਣੀ ਰੁਚੀ ਵਧਾਉਣੀ ਚਾਹੀਦੀ ਹੈ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਰੋਜ਼ ਖੇਡਾਂ ਵਿਚ ਸਫਲਤਾ ਅਤੇ ਅਸਫਲਤਾ ਜੇਕਰ ਖਿਡਾਰੀ ਨੂੰ ਅਸਫਲਤਾ ਨਾ ਮਿਲੇ ਤਾਂ ਉਹ ਕਦੇ ਵੀ ਸਫਲ ਹੋਣ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਅਗਰ ਖਿਡਾਰੀ ਇੱਕ ਵਾਰ ਅਸਫਲ ਹੋ ਜਾਂਦਾ ਹੈ ਤਾਂ ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਵੱਧ ਚੜ੍ਹ ਕੇ ਮਿਹਨਤ ਕਰਕੇ ਹੋਰ ਤੋਂ ਹੋਰ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰ ਸਕਦਾ ਹੈ ਜੇਕਰ ਸਫਲਤਾ ਪ੍ਰਾਪਤ ਹੋ ਜਾਵੇ ਤਾਂ ਉਸਦਾ ਉਤਸਾਹ ਹੋਰ ਵੱਧ ਜਾਂਦਾ ਹੈ ਅਤੇ ਉਹ ਖਿਡਾਰੀ ਵੱਧ ਤੋਂ ਵੱਧ ਚੜ੍ਹ ਕੇ ਖੇਡਾਂ ਵਿੱਚ ਜੋ ਕਿ ਪਾਟ ਲੈਂਦਾ ਹੈ ਇਸ ਦੇ ਕੁਝ ਲਾਭ ਵੀ ਹੁੰਦੇ ਹਨ ਜਿਵੇਂ ਕਿ ਖੇਡਾਂ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀਆਂ ਹਨ ਇਹ ਸਰੀਰ ਨੂੰ ਫਿੱਟ ਅਤੇ ਚੁਸਤ ਬਣਾਉਂਦੀਆਂ ਹਨ ਖੇਡਦੇ ਸਮੇਂ ਜਦੋਂ ਸਾਡਾ ਪਸੀਨਾ ਆਉਂਦਾ ਹੈ ਤਾਂ ਸਾਡੀ ਗੰਦਗੀ ਜੋ ਕਿ ਹੈ ਉਹ ਬਾਹਰ ਕੱਢਦਾ ਹੈ ਖੂਨ ਦਾ ਪਰਵਾਹ ਜੋ ਕਿ ਵਧਦਾ ਹੈ ਅਤੇ ਪਾਚਕ ਕਿਰਿਆ ਦਾ ਸੁਤੰਤਰ ਜੋ ਕਿ ਸੁਧਾਰ ਹੁੰਦਾ ਇਸ ਨਾਲ ਵਿਅਕਤੀ ਦੀ ਕਾਰਜ ਕੁਸ਼ਲਤਾ ਵਧਦੀ ਹੈ ਇਸ ਨਾਲ ਵਿਅਕਤੀ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਹਨ